ਅੱਜ ਕੱਲ੍ਹ ਆਪਣੀ ਪੰਜਾਬੀ ਭਾਸ਼ਾ ਨੂੰ ਸਾਂਭਣ ਨੂੰ ਬਹੁ ਤਰੀਕੇ ਨਾਲ ਅਹਿਮੀਅਤ ਮਿਲਦੀ ਆ ਪਰ ਪੁਰਾਣੇ ਸਮੇਂ ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਪੰਜਾਬ 'ਤੇ ਰਾਜ ਕੀਤਾ ਸੀਗਾ ਅਤੇ ਉੱਥੇ ਕੋਈ ਹੈ ਵੀ ਨਹੀਂ ਸੀਗਾ ਕਿਹੜਾ ਰਾਜ ਸੁਰਾ ਛੁਡਾ ਸਕੇ ਅਤੇ ਉਸ ਤੋਂ ਬਾਅਦ ਓਹ ਹਰੀ ਮਹਾਰਾਜਾ ਰਣਜੀਤ ਸਿੰਘ ਆਏ ਸੀਗੇ ਅਤੇ ਉਹਨਾਂ ਨੇ ਅੰਗਰੇਜ਼ਾਂ ਨੂੰ ਪੰਜਾਬ ਵਿੱਚੋਂ ਭਜਾ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ ਸੀਗਾ ਅਤੇ ਉਸ ਤੋਂ ਬਾਚੋਂ ਉੱਥੇ ਜ਼ਿਆਦਾਤਰ ਲੋਕ ਅੰਗਰੇਜ਼ੀ ਬੋਲਦੇ ਸੀਗੇ ਪਰ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਚੀ ਚੀਜ਼ਾਂ ਦੱਸੀਆਂ ਉਹਨਾਂ ਨੂੰ ਅਤੇ ਉਸ ਤੋਂ ਬਾਚੋਂ ਉਹਨਾਂ ਨੇ ਸੋਚਿਆ ਕਿ ਇਹਨਾਂ ਸਾਰਿਆਂ ਨੂੰ ਪੰਜਾਬੀ ਬੋਲਣ ਲਾਇਆ ਜਾਵੇ ਕਿਉਂਕਿ ਪੰਜਾਬੀ ਸਾਰਿਆਂ ਦੀ ਮਾਂ ਬੋਲੀ ਹੈ ਉਸ ਤੋਂ ਬਾਅਦ ਜੋ ਲੋਕ ਲੋਕਾਂ ਨੇ ਬਹੁਤ ਜ਼ਿਆਦਾ ਅਲੱਗ ਅਲੱਗ ਚੀਜ਼ਾਂ ਕੀਤੀਆਂ ਪੰਜਾਬੀਆਂ ਨੂੰ ਸਿੱਖਣ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਨੂੰ ਪੰਜਾਬੀ ਦੇ ਵਿੱਚ ਬੜੀ ਅਲੱਗ ਅਲੱਗ ਚੀਜ਼ਾਂ ਲਿਖੀਆਂ ਅਤੇ ਪੰਜਾਬੀ ਬਹੁਤ ਵਧੀਆ ਇੱਕ ਲੈਂਗੁਏਜ ਆ ਅਤੇ ਸਾਰੇ ਲੋਕਾਂ ਨੂੰ ਪੰਜਾਬੀ ਪੜ੍ਹਨੀ ਚਾਹੀਦੀ ਹੈ ਅੱਜ ਕੱਲ੍ਹ ਪੰਜਾਬੀ ਨੂੰ ਬਹੁ ਜ਼ਿਆਦਾ ਲੋਕ ਪ੍ਰੈਫਰੈਂਸ ਦਿੰਦੇ ਆ ਅਤੇ ਆ ਜਾਣੀ ਪਛਾਣੀ ਭਾਸ਼ਾ ਵੀ ਬਣ ਚੁੱਕੀ ਹੈ ਕਿਉਂਕਿ ਪੰਜਾਬੀ ਦੇ ਵਿੱਚ ਆਪਾਂ ਆਰਾਮ ਨਾਲ ਕਿਸੇ ਨੂੰ ਵੀ ਕੁਛ ਵੀ ਦੱਸ ਸਕਦੇ ਹਾਂ ਅਤੇ ਪੰਜਾਬੀ ਇੱਕ ਬਹੁਤ ਵਧੀਆ ਭਾਸ਼ਾ ਏ ਅਤੇ ਪੰਜਾਬੀ ਨੂੰ ਸੰਭਾਲਣ ਲਈ ਲੋਕਾਂ ਨੇ ਬੜੇ ਅਲੱਗ ਅਲੱਗ ਤਰੀਕੇ ਦੇ ਕਿਤਾਬਾਂ ਲਿਖੀਆਂ ਏ ਜਿਹਦੇ ਕਰਕੇ ਪੰਜਾਬੀ ਲੋਕ ਪੜ੍ਹਦੇ ਰਹਿੰਦੇ ਆ ਅਤੇ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਪੰਜਾਬੀ ਪੜ੍ਹਨ ਲੱਗ ਗਏ ਆ ਜਵਾਕ ਜਿਹਦੇ ਕਰਕੇ ਉਹ ਆਪਣੀ ਮਾਂ ਭਾਸ਼ਾ ਦੇ ਵਿੱਚ ਕਨੈਕਟ ਰਹਿਣ ਕਨੈਕਟ ਰਹਿਣ ਅਤੇ ਪੰਜਾਬੀ ਇੱਕ ਬਹੁਤ ਵਧੀਆ ਲੈਂਗੁਏਜ ਆ ਕਿ ਇਹਦੇ ਵਿੱਚ ਆਪਾਂ ਬਹੁਤ ਅਲੱਗ ਅਲੱਗ ਚੀਜ਼ਾਂ ਸਿੱਖ ਸਕਦੇ ਹਾਂ